ਹੈਲੋ ਹਾਂਜੀ ਹੋਮ ਹੋਮ ਰੈਸਟੋਰੈਂਟ ਤੋਂ ਬੋਲ ਰਹੇ ਹੋ ਹਾਂਜੀ ਮੈਂ ਨਾ ਓਡਰ ਬੁੱਕ ਕਰਨਾ ਸੀ ਹਾਂਜੀ ਤੁਸੀਂ ਮੈਨੂੰ ਦੱਸੋ ਆਪਦਾ ਕੀ ਕੁਛ ਹੁੰਦਾ ਤੁਹਾਡੇ ਕੀ ਬਣਿਆ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਅਤੇ ਮਤਲਬ ਚਪਾਤੀਆਂ ਵਗੈਰਾ 'ਚ ਕਿਵੇਂ ਹਾਂਜੀ ਚਲੋ ਤੁਸੀਂ ਫਿਰ ਕੀ ਨਾਮ ਕਿਵੇਂ ਮਤਲਬ ਸਪਾਇਸੀ ਨਾ ਹੋਵੇ ਜ਼ਿਆਦਾ ਫੂਡ ਠੀਕ ਹੈ ਹਾਂਜੀ ਅਤੇ ਫਿਰ ਕੀ ਨਾਮ ਜੇ ਮੰਨ ਲੋ ਕੁਛ ਹੋਰ ਮਿੱਠੇ 'ਚ ਅਸੀਂ ਓਡਰ ਕਰਨਾ ਹੋਵੇ ਨਾਲ ਸਵੀਟਸ ਵੀ ਹਮ ਠੀਕ ਹੈ ਹਾਂਜੀ ਹਾਂਜੀ ਅੱਛਾ ਠੀਕ ਹੈ ਨਹੀਂ ਫਿਰ ਕੀ ਨਾਮ ਇੱਕ ਦਮ ਦੇਖੋ ਫਰੈਸ਼ ਦੇਣੀ ਆਈਟਮ ਜਿੰਨੀ ਵੀ ਦੇਣੀ ਆ ਕਿਉਂਕੀ ਸਾਡੇ ਥੋੜ੍ਹਾ ਜਿਹਾ ਹਮ ਕਿਉਂਕੀ ਥੋੜ੍ਹਾ ਜਿਹਾ ਹੈਲਦੀ ਹਾਂਜੀ ਹਾਂਜੀ ਪਹਿਲੀ ਵਾਰੀ ਓਡਰ ਕਰਨ ਲੱਗੀ ਹਾਂ ਨਾ ਅੱਛਾ ਚਲੋ ਫਿਰ ਤੁਸੀਂ ਲਿਖ ਲੋ ਮੈਂ ਜਿਹੜਾ ਓਡਰ ਦੇਣਾ ਹਾਂਜੀ ਇੱਕ ਤਾਂ ਪਲੇਨ ਰਾਈਸ ਹਾਂਜੀ ਦੋ ਬਾਊਲ ਪਲੇਨ ਰਾਈਸ ਅਤੇ ਦੋ ਬਾਊਲ ਕੜਾਹੀ ਪਨੀਰ ਹਾਂਜੀ ਇੱਕ ਬਾਊਲ ਡਾਈ ਕੀ ਨਾਮ ਸ਼ਾਈ ਕੀ ਨਾਮ ਕੀ ਕੀ ਕਹਿੰਦੇ ਉਹਨੂੰ ਦਾਲ ਮੱਖਣੀ ਹਾਂ ਅਤੇ ਫੁਲਕਾ ਤੁਸੀਂ ਮਿੱਸ ਮਿੱਸੀ ਰੋਟੀ ਰੱਖ ਦਿਆ ਜੇ ਹਾਂਜੀ ਹਾਂਜੀ ਹਾਂ ਹਾਂ ਕੋਈ ਨਹੀਂ ਤੁਸੀਂ ਲਸਣ ਪਿਆਜ ਜਿਹੜਾ ਵੀ ਜਿਵੇਂ ਵੀ ਯੂਜ ਕਰਨਾ ਪਰ ਸਪਾਈਸ ਹਾਂ ਥੋੜ੍ਹੇ ਜਿਹੇ ਹਲਕੇ ਸਪਾਈਸ ਹਾਂ ਹਾਂਜੀ ਜ਼ਿਆਦਾ ਸਪਾਈਸੀ ਨਹੀਂ ਰੱਖਣੇ ਅਤੇ ਹਾਂ ਹਮ ਔਰ ਰੋਟੀ ਜਿਹੜੀ ਹੈ ਉਹ ਤੁਸੀਂ ਵੈਸੇ ਹੀ ਦੇ ਦਿਓ ਚੋਪੜੀ ਨਹੀਂ ਦੇਣੀਆਂ ਮਤ ਮਤਲਬ ਮੱਖਣ ਵਗੈਰਾ ਕੁਛ ਨਹੀਂ ਹਾਂਜੀ ਹਮ ਅਤੇ ਕੀ ਨਾਮ ਕਿਵੇਂ ਤੁਸੀਂ ਕਰੋਂਗੇ ਡਿਲਵਰੀ ਵਗੈਰਾ ਕਿੰਨੀ ਕੁ ਦੇਰ 'ਚ ਹੋਜੇਗੀ ਹਮ ਠੀਕ ਹੈ ਅਤੇ ਤੁਸੀਂ ਬਿੱਲ ਵਗੈਰਾ ਸਾਰਾ ਬਣਾ ਕੇ ਹਮ ਠੀਕ ਹੈ ਠੀਕ ਠੀਕ ਹੈ ਹਮ ਤੁਸੀਂ ਫਿਰ ਛੇਤੀ ਭਿਜਵਾ ਦਿਓ ਜਿੰਨੀ ਜਲਦੀ ਹੋ ਸਕੇ ਠੀਕ ਹੈ ਜੀ ਮੈਂ ਐਡਰੈੱਸ ਸੈਂਡ ਕਰ ਦੇਣੀ ਹਾਂ ਤੁਹਾਨੂੰ ਠੀਕ ਹੈ ਓਕੇ ਥੈਂਕ ਯੂ